ਮੈਂ ਸਵੇਰੇ ਉੱਠ ਕੇ ਬਦਾਮ ਜਾਂ ਛੋਲੇ ਖਾ ਕੇ ਰੋਜ਼ ਸੌ ਮੀਟਰ ਦੌੜ ਭੱਜ ਦੌੜ ਕਰਦਾ ਹਾਂ ਅਤੇ ਮੈਂ ਲੋਕਾਂ ਨੂੰ ਵੀ ਇਹ ਹੀ ਸਲਾਹ ਦਿੰਦਾ ਹਾਂ ਕਿ ਤੁਸੀਂ ਵੀ ਦੌੜ ਕਰੋ ਇਸ ਦੌੜ ਇਸ ਨਾਲ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ ਫਿੱਟ ਰਹਿੰਦੀ ਹੈ ਤੁਹਾਨੂੰ ਤਲਿਆ ਨਹੀਂ ਖਾਣਾ ਚਾਹੀਦਾ ਇਸ ਨਾਲ ਸਾਹ ਵੀ ਘੱਟ ਹੁੰਦਾ ਹੈ ਜੇ ਆਪਾਂ ਰੋਜ਼ ਸੌ ਮੀਟਰ ਦੀ ਦੌੜ ਭੱਜਾਂਗੇ ਤਾਂ ਆਪਾਂ ਨੂੰ ਸਾਹ ਵੀ ਘੱਟ ਚੜੂਗਾ ਅਤੇ ਆਪਾਂ ਨੂੰ ਲੋਕ ਮੋਟੀਵੇਟ ਵੀ ਵੱਧ ਕਰਨਗੇ ਇਸ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ਸਿਹਤ ਫਿੱਟ ਵੀ ਫਿੱਟ ਵੀ ਬਹੁਤ ਰਹਿੰਦੀ ਹੈ ਮੈਂ ਜੇ ਜਿਹੜੇ ਮੇਰੇ ਮੈਂ ਆਪਣੇ ਯਾਰ ਆਪਣੇ ਫਰੈਂਡਸ ਨੂੰ ਵੀ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਨੇ ਤੁਸੀਂ ਵੀ ਸਵੇਰੇ ਉੱਠ ਕੇ ਮੇਰੇ ਨਾਲ ਸੈਰ ਕਰਿਆ ਕਰੋ ਜਾਂ ਸੌ ਮੀਟਰ ਦੀ ਦੌੜ ਰੋਜ਼ ਕਰਿਆ ਕਰੋ ਇਸ ਨਾਲ ਤੁਸੀਂ ਵੀ ਤੰਦਰੁਸਤ ਰਹੋਂਗੇ ਅਤੇ ਮੈਂ ਸਾਰਿਆਂ ਨੂੰ ਵੀ ਇਹ ਹੀ ਸਲਾਹ ਦਿੰਦਾ ਹਾਂ ਕਿ ਤੁਸੀਂ ਵੀ ਭੱਜੋ ਅਤੇ ਆਪਣੀ ਤੰਦਰੁਸਤੀ ਰੱਖੋ ਤਾਂ ਜੋ ਤੁਸੀਂ ਅਗਾਂਹ ਤੁਹਾਨੂੰ ਕੋਈ ਔਖ ਨਾ ਆਵੇ ਮੈਰਾਥਨ ਦੋੜ 'ਚ ਵੀ ਮੈਂ ਮੈਂ ਜਦੋਂ ਮੈਂ ਭੱਜਦਾ ਪ੍ਰੈਕਟਿਸ ਕੀਤੀ ਤਾਂ ਮੈਂ ਮੈਰਾਥਨ ਦੌੜ ਵਿੱਚ ਵੀ ਹਿੱਸਾ ਲਿਆ ਉਸ ਵਿੱਚ ਚਾਰ ਸੌ ਕਿਲੋਮੀਟਰ ਦੀ ਦੌੜ ਸੀ ਅਤੇ ਮੈਂ ਉਹਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਮਿਹਨਤ ਕਰਨ ਨਾਲ ਆਪਾਂ ਨੂੰ ਸਭ ਕੁਛ ਮਿਲ ਜਾਂਦਾ ਹੈ ਤੁਹਾਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਥੈਂਕ ਯੂ